ਇਸ ਵਿੱਚ ਕੋਈ ਸ਼ੱਕ ਨਹੀਂ ਅੱਜ ਕੱਲ੍ਹ ਹਰ ਇੱਕ ਘਰ ਦੇ ਵਿੱਚ ਐੱਲ ਪੀ ਜੀ ਗੈਸ ਹੈ ਪਰ ਪਹਿਲਾਂ ਕੀ ਹੁੰਦਾ ਸੀਗਾ ਜਿਹੜੇ ਪਹਿਲਾਂ ਜਦੋਂ ਐੱਲ ਪੀ ਜੀ ਦਾ ਕਨੈਕਸ਼ਨ ਨਹੀਂ ਸੀ ਜਾਂ ਕਿਸੇ ਕਿਸੇ ਘਰ ਸੀ ਪਹਿਲਾਂ ਲੋਕ ਕੀ ਕਰਦੇ ਸੀਗੇ ਬਾਹਰ ਜਾਂਦੇ ਸੀਗੇ ਕਿਉਂ ਉਹਨਾਂ ਦੇ ਜਿਵੇਂ ਦਰਖਤਾਂ ਦੇ ਪੱਤੇ ਗਿਰੇ ਵੇ ਦਰਖਤਾਂ ਦੇ ਕੋਈ ਸੁੱਕੀਆਂ ਟਾਹਣੀਆਂ ਗਿਰੀਆਂ ਵੀਆ ਉਹ ਚੱਕ ਲਿਆਉਂਦੇ ਤੇ ਪਹਿਲਾਂ ਦਰਖਤ ਵੀ ਅਸਲ ਦੇ ਵਿੱਚ ਵਾਧੂ ਹੁੰਦੇ ਸੀਗੇ ਕੋਈ ਮਾੜਾ ਮੋਟਾ ਸਿੰਗਾਈ ਕਰ ਲੈਣਾ ਉਸ ਦੇ ਨਾਲ ਛੇ ਮਹੀਨੇ ਦਾ ਆਪਣਾ ਲੱਕੜ ਇਕੱਠੀ ਕਰਕੇ ਰੱਖ ਲੈਣੀ ਜਿਵੇਂ ਪਾਪੂਲਰ ਲਾ ਲਏ ਹੁਣ ਇਸ ਵਾਰ ਪਾਪੂਲਰ ਦਾ ਰੁਝਾਨ ਲੋਕਾਂ ਵੱਲ ਬਹੁਤ ਘੱਟ ਗਿਆ ਉਹ ਪ ਉਸ ਟਾਈਮ ਪਰ ਇਹ ਵੀ ਸੀਗਾ ਨਾ ਜਦੋਂ ਲੱਕੜ ਦੀ ਵਰਤੋਂ ਕਰਦੇ ਸੀਗੇ ਇੱਕ ਤਾਂ ਧੂੰਆਂ ਬਹੁਤ ਹੁੰਦਾ ਸੀ ਇੱਕ ਉਹ ਨਾ ਅੱਖਾਂ ਦੇ ਵਿੱਚ ਜਦੋਂ ਅ ਜ ਜਨਾਨੀਆਂ ਕੰਮ ਕਰਦੇ ਤੀਆਂ ਉਹਨਾਂ ਅੱਖਾਂ ਦੇ ਵਿੱਚ ਧੂੰਆਂ ਪੈਂਦਾ ਤਾ ਉਹਨਾਂ ਦੀਆਂ ਅੱਖਾਂ ਦੀ ਨਿਗ੍ਹਾ ਪਰ ਅਸਰ ਪੈਂਦਾ ਤਾ ਇਹਨੂੰ ਟਾਈਮ ਬਹੁਤ ਜ਼ਿਆਦਾ ਲੱਗਦਾ ਤਾ ਪਰ ਜੋ ਹੁਣ ਦੀ ਨਵੀਂ ਸਹੂਲਤ ਟਾਈਮ ਦੀ ਘਾਟ ਹੋਣ ਕਰਕੇ ਹੁਣ ਆ ਗਏ ਐੱਲ ਪੀ ਜੀ ਕਨੈਕਸ਼ਨ ਜਿਹੜੇ ਇਹ ਕਨੈਕਸ਼ਨ ਇਹਨਾਂ ਨਾਲ ਸਹੂਲਤ ਬਹੁਤ ਆ ਜਦੋਂ ਵੀ ਆਪਾਂ ਨੇ ਕੋਈ ਵੀ ਛੋਟਾ ਮੋਟਾ ਕੰਮ ਕਰਨਾ ਨਹੀਂ ਤਾਂ ਪਹਿਲਾਂ ਤਾਂ ਲੱਕੜ ਬਾਲ ਚੁੱਲ੍ਹਾ ਬਾਲਣਾ ਉਹ ਤੋਂ ਬਾਅਦ ਫਿਰ ਕਿੰਨਾ ਕਿੰਨਾ ਚਾਹੇ ਛੋਟਾ ਜਿਹਾ ਕੰਮ ਹੋਵੇ ਅੱਗ ਬਾਲਣ ਨੂੰ ਓਨਾਂ ਹੀ ਟਾਈਮ ਲੱਗ ਜਾਂਦਾ ਤਾ ਪਰ ਹੁਣ ਕੀ ਆ ਹੁਣ ਚਾਹੇ ਥੋੜ੍ਹਾ ਕੰਮ ਆ ਚਾਹੇ ਜ਼ਿਆਦਾ ਕੰਮ ਆ ਕਨੈਕਸ ਸਹੂਲਤ ਹੋ ਗਈ ਜਦੋਂ ਮਾੜਾ ਜਿਹਾ ਆਪਣਾ ਇੱਕ ਕਲਿੱਕ ਕਰਨਾ ਜਦੋਂ ਵਰਤੋਂ ਕੀਤੀ ਉਹਨੂੰ ਜਦੇ ਬੰਦ ਕਰਤਾ ਇਹ ਚੀਜ਼ ਆ ਜਿਹੜੀ ਫਰਕ ਜ਼ਰੂਰ ਪਿਆ ਸਹੂਲਤ ਦੇ ਨਾਲ ਚਲੋ ਸਮੇਂ ਦੇ ਨਾਲ ਚੇਂਜ ਕਰਨਾ ਵੀ ਪੈਂਦਾ ਹੈ